ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਡਿਤਾਂ ਦੇ ਢਾਬੇ ਤੋਂ ਗੱਲ ਕਰ ਰਹੇ ਹੋ ਮੈਂ ਹੁਣੇ ਹੁਣੇ ਇੱਕ ਆਰਡਰ ਦਿੱਤਾ ਸੀ ਮੇਰਾ ਨਾਮ ਕਿਰਨਜੋਤ ਕੌਰ ਹੈ ਇਹ ਆਰਡਰ ਸੀਗਾ ਇੱਕ ਆਲੂ ਗੋਭੀ ਦੀ ਸਬਜ਼ੀ ਦਾ ਇੱਕ ਪਨੀਰ ਦੀ ਸਬਜ਼ੀ ਦਾ ਜਿਹਦੇ ਵਿੱਚ ਦਸ ਰੋਟੀਆਂ ਸੀ ਦੋ ਸਲਾਦ ਦੀ ਪਲੇਟਾਂ ਸੀ ਦੋ ਰਾਇਤੇ ਸੀ ਅਤੇ ਪੰਜ ਸਮੋਸੇ ਹਰੀ ਚਟਨੀ ਅਤੇ ਲਾਲ ਚਟਨੀ ਦੇ ਨਾਲ ਸੀ ਪਹਿਲਾਂ ਇਹ ਆਰਡਰ ਮੈਂ ਆਪਣੀ ਦੁਕਾਨ ਦੇ ਪਤੇ 'ਤੇ ਦੇਣ ਵਾਸਤੇ ਤੁਹਾਨੂੰ ਕਿਹਾ ਸੀ ਹੁਣ ਲੇਕਿਨ ਹੁਣ ਇਹ ਅਸੀਂ ਆਰਡਰ ਆਪਣੇ ਘਰ ਮੰਗਵਾਉਣਾ ਚਾਹੁੰਦੇ ਹਾਂ ਤੁਸੀਂ ਕਿਰਪਾ ਕਰਕੇ ਸਾਡੀ ਦੁਕਾ ਦਾ ਐਡਰੈਸ ਕੱਟ ਕੇ ਸਾਡੇ ਘਰ ਦਾ ਪਤਾ ਨੋਟ ਕਰ ਲਓ ਸਾਡੇ ਘਰ ਦਾ ਪਤਾ ਹੈ ਇੰਦਰਜੀਤ ਸਿੰਘ ਸਨ ਆਫ ਪ੍ਰੀਤਮ ਸਿੰਘ ਨੀਅਰ ਗੁਰਦੁਆਰਾ ਭਾਈ ਜਗਤਾ ਜੀ ਸਿਨੇਮਾ ਰੋਡ ਹਾਜੀਵਾਲ ਹਾਜੀਵਾਲਾ ਕਾਰਖਾਨਾ ਬੁਢਲਾਡਾ ਪਲੀਜ਼ ਕਿਰਪਾ ਕਰਕੇ ਮੇਰਾ ਪਹਿਲਾਂ ਵਾਲਾ ਆਰਡਰ ਜੋ ਕਿ ਕੀਰਤ ਹੈਡਲੂਮ ਲੁਕਸ ਅ ਸਾਡੀ ਦੁਕਾਨ ਦੇ ਉੱਪਰ ਕੀਤਾ ਹੋਇਆ ਸੀ ਉਹਨੂੰ ਕੱਟ ਕੇ ਇਸ ਨਵੇਂ ਪਤੇ 'ਤੇ ਕਰਨ ਦੀ ਕਿਰਪਾਲਤਾ ਕਰਨੀ ਧੰਨਵਾਦ